ਸਾਡੇ ਰਾਜ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਇਲਾਕਾ ਲੁਧਿਆਣਾ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਜਲੰਧਰ ਮੋਹਾਲੀ ਪਟਿਆਲਾ ਬਠਿੰਡਾ ਇਹ ਸਭ ਸ਼ਹਿਰ ਆਉਂਦੇ ਹਨ ਅਤੇ ਮੈਂ ਖੁਦ ਅੰਮ੍ਰਿਤਸਰ ਹੀ ਰਹਿੰਦਾ ਹਾਂ ਅਤੇ ਸ਼ਹਿਰ 'ਚ ਰਹਿਣ ਦੇ ਕਈ ਫ਼ਾਇਦੇ ਵੀ ਹਨ ਅਤੇ ਕਈ ਨੁਕਸਾਨ ਵੀ ਹਨ ਜੋ ਕਿ ਅਸੀਂ ਡਿਸਕਸ ਕਰ ਸਕਦੇ ਹਾਂ ਹੁਣੇ ਫ਼ਾਇਦੇ ਹਨ ਕਿ ਤੁਹਾਨੂੰ ਫੈਸਿਲਿਟੀ ਸਭ ਮਿਲਦੀ ਹੈ ਕੋਈ ਵੀ ਐਮਰਜੰਸੀ ਹੋ ਜਾਵੇ ਤੁਹਾਨੂੰ ਹਰ ਚੀਜ਼ ਕੁਛ ਕਦਮਾਂ 'ਤੇ ਮਿਲ ਜਾਂਦੀ ਹੈ ਚਾਹੇ ਹਸਪਤਾਲ ਹੋਣ ਚਾਹੇ ਕੋਈ ਕੋਈ ਚੀਜ਼ ਖਰੀਦਣੀ ਹੋਵੇ ਕੋਈ ਖਾਣ ਪੀਣ ਦੀ ਲੋੜ ਹੋਵੇ ਕੋਈ ਚੀਜ਼ ਦੀ ਅਰ ਇੱਦਾਂ ਅਣਗਿਣਤ ਕਈ ਚੀਜ਼ਾਂ ਹਨ ਜੋ ਕਿ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਹਨ ਘਰ ਬੈਠੇ ਵੀ ਮਿਲ ਜਾਂਦੀਆਂ ਹਨ ਸੋਸ਼ਲ ਮੀਡੀਆ 'ਤੇ ਕਈ ਆਨਲਾਈਨ ਅੱਜ ਕੱਲ੍ਹ ਐਪਸ ਆ ਗਈਆਂ ਕਿ ਘਰ ਬੈਠੇ ਤੁਸੀਂ ਸੌਦਾ ਮੰਗਵਾ ਸਕਦੇ ਹੋ ਘਰ ਬੈਠੇ ਤੁਸੀਂ ਖਾਣਾ ਮੰਗਵਾ ਸਕਦੇ ਹੋ ਘਰ ਬੈਠੇ ਤੁਸੀਂ ਫਰਨੀਚਰ ਮੰਗਵਾ ਸਕਦੇ ਹੋ ਆਪਣੇ ਫਰਿਜ ਵਾਸ਼ਿੰਗ ਮਸ਼ੀਨ ਸਭ ਘਰ ਬੈਠੇ ਮੰਗਵਾ ਸਕਦੇ ਹੋ ਇਹ ਸਭ ਚੀਜ਼ਾਂ ਤੁਹਾਡਾ ਹੀ ਸਮੇਂ ਬਚਾਉਂਦੀਆਂ ਹਨ ਅਤੇ ਤਾਂ ਕੀ ਤੁਸੀਂ ਆਪਣਾ ਕੰਮ ਜਾਂ ਜੋ ਵੀ ਤੁਹਾਡਾ ਕੰਮ ਹੈ ਉਹ ਕਰ ਸਕੋ ਅਤੇ ਇਹਨਾਂ ਚੀਜ਼ਾਂ 'ਚ ਤ ਨੂੰ ਵਿੱਚ ਟਾਈਮ ਬਚਾ ਸਕੋ ਬਟ ਨਾਲ ਦੀ ਨਾਲ ਸ਼ਹਿਰ 'ਚ ਜਿਹੜਾ ਰਹਿਣ ਦਾ ਮਾਹੌਲ ਹੁੰਦਾ ਹੈ ਭੀੜ ਭੜੱਕੇ ਵਿੱਚ ਰੋਜ਼ ਟਰੈਫਿਕ ਚੋਂ ਲੰਘ ਕੇ ਉਹ ਤੁਹਾਡੀ ਸਿਹਤ 'ਤੇ ਕਾਫ਼ੀ ਅਸਰ ਕਰਦਾ ਹੈ ਤੁਹਾਡੇ ਕਹਿ ਲਓ ਮਨ ਮਾਇੰਡ 'ਤੇ ਕਫੀ ਕਾਫ਼ੀ ਅਸਰ ਕਰਦਾ ਹੈ ਅਗਰ ਕੰਪੇਅਰ ਕੀਤਾ ਜਾਵੇ ਥੋੜ੍ਹੇ ਛੋਟੀ ਪਿੰਡਾਂ ਜਾਂ ਕਸਬਿਆਂ ਦੀ ਲਾਈਫ ਨਾਲ ਜਿੱਥੇ ਲੋਕ ਥੋੜ੍ਹੀ ਸਲੋਅ ਲਾਈਫ ਜੀ ਰਹੇ ਹਨ ਉਹ ਉਹ ਉਹ ਦੇ ਮੁ ਹਿਸਾਬ ਨਾਲ ਸ਼ਹਿਰਾਂ ਦੀ ਜਿਹੜੀ ਲਾਈਫ ਹੈ ਉਹ ਕਾਫ਼ੀ ਪਰੇਸ਼ਾਨੀ ਵਾਲੀ ਹੈ ਕਾਫ਼ੀ ਜ਼ਿਆਦਾਤਰ ਲੋਕ ਸ਼ਹਿਰ 'ਚ ਰਹਿਣ ਵਾਲੇ ਕਾਫ਼ੀ ਟੈਨਸਡ ਪਰੇਸ਼ਾਨ ਵੀ ਰਹਿੰਦੇ ਹਨ ਉਹਨਾਂ ਦੀਆਂ ਜਿੰਮੇਵਾਰੀਆਂ ਵੀ ਜ਼ਿਆਦਾ ਹੋ ਜਾਂਦੀਆਂ ਹਨ ਖ਼ਰਚੇ ਵੱਧ ਜਾਂਦੇ ਹਨ ਉਹ ਉਸੇ ਸਰਕਲ 'ਚ ਫਿਰ ਫਸ ਜਾਂਦੇ ਹਨ ਖ਼ਰਚੇ ਹੈ ਤਾਂ ਖ਼ਰਚੇ ਪੂਰੇ ਕਰਨ ਲਈ ਫਿਰ ਕੰਮ ਕਰਨਾ ਪੈਂਦਾ ਅਤੇ ਉਹ ਆਪਣਾ ਮਤਲਬ ਕਈ ਲੋਕ ਜੀਵਨ ਇੱਦਾਂ ਹੀ ਬਿਤਾ ਦਿੰਦੇ ਹਨ ਬਾਕੀ ਕਈ ਸ਼ਹਿਰ ਹਨ ਜਿਹੜੇ ਕਿ ਮਤਲਬ

ਮਤਲਬ ਆਬਾਦੀ ਤੱਕ ਹੋਣ ਮਤਲਬ ਕਈ ਹਨ ਜਿੱਦਾਂ ਪਟਿਆਲਾ ਸ਼ਹਿਰ ਹੋ ਗਿਆ ਮੋਹਾਲੀ ਚੰਡੀਗੜ੍ਹ ਹੋ ਗਿਆ ਜਿਹੜੇ ਕਿ ਇੰਨੇ ਜ਼ਿਆਦਾ ਵੀ ਭੀੜ ਭੜੱਕੇ ਵਾਲੇ ਨਹੀਂ ਹਨ ਅਤੇ ਜਿਹਨਾਂ 'ਚ ਰਹਿਣ ਦੇ ਫ਼ਾਇਦੇ ਨੁਕਸਾਨ ਨਾਲੋਂ ਵੱਧ ਹਨ ਅਤੇ ਕੁਛ ਸ਼ਹਿਰ ਹਨ ਆਪਣੇ ਲੁਧਿਆਣੇ ਵਰਗੇ ਜੋ ਕਿ ਬਹੁਤ ਹੀ ਜ਼ਿਆਦਾ ਭੀੜ ਭੜੱਕੇ ਵਾਲੇ ਹਨ ਜਿੱਥੇ ਫ਼ਾਇਦੇ ਤੋਂ ਜ਼ਿਆਦਾ ਫਿਰ ਨੁਕਸਾਨ ਹੋ ਜਾਂਦੇ ਹਨ ਕਿ ਜੋ ਤੁਹਾਡੀ ਸਿਹਤ 'ਤੇ ਜੋ ਤੁਹਾਡੇ ਰੋਜ਼ ਜੀਵਨ 'ਤੇ ਜੋ ਉਹਨਾਂ ਕਰਕੇ ਅਸਰ ਹੁੰਦਾ ਹੈ ਅਤੇ ਹਾਂਜੀ ਦੋਨੋਂ ਤਰ੍ਹਾਂ ਦੇ ਪਹਿਲੂ ਹਨ ਸ਼ਹਿਰੀ ਜੀਵਨ ਬਿਤਾਉਣ ਦੇ